ਹਾਂਜੀ ਬਾਗਬਾਨੀ ਕਰਨ ਵਾਸਤੇ ਮੈਨੂੰ ਸ਼ੁਰੂ ਵਿੱਚ ਮੈਂ ਬਾਹਰ ਜਾ ਕੇ ਲਾਗੇ ਸਾਡੇ ਪਾਰਕ ਸੀਗਾ ਉੱਥੇ ਜਾਂਦਾ ਹੁੰਦਾ ਸੀਗਾ ਉੱਥੇ ਮੈਨੂੰ ਬਹੁਤ ਅੱਛਾ ਮਹਿਸੂਸ ਹੁੰਦਾ ਸੀ ਉੱਥੇ ਜਾ ਕੇ ਸਵੇਰੇ ਸਵੇਰੇ ਜਿਹੜੇ ਫੁੱਲ ਖਿਲੇ ਹੁੰਦੇ ਸਨ ਹਰਿਆਲੀ ਚਾਰੋਂ ਤਰਫ਼ ਮਿਲਣੀ ਅਤੇ ਉਥੋਂ ਦੀ ਸ਼ੁੱਧ ਹਵਾ ਮੈਨੂੰ ਮਿਲਦੀ ਸੀਗੀ ਜਿਸ ਕਰਕੇ ਮੈਨੂੰ ਇਹ ਪ੍ਰੇਰਣਾ ਮਿਲੀ ਕਿ ਮੈਂ ਇਹ ਉਪਰਾਲਾ ਆਪਣੇ ਘਰ ਦੇ ਵਿੱਚ ਹੀ ਕਿਉਂ ਨਾ ਕਰਾਂ ਮੇਰੇ ਕੋਲ ਘਰ ਦੇ ਅੰਦਰ ਥੋੜ੍ਹੀ ਜਿਹੀ ਜਗ੍ਹਾ ਸੀਗੀ ਮੈਂ ਉੱਥੇ ਹੀ ਉਹ ਫੁੱਲ ਬੂਟੇ ਲਗਾਉਣ ਦੀ ਕੋਸ਼ਿਸ਼ ਕਰਾਂ ਤਾਂ ਕਿ ਮੈਨੂੰ ਬਾਹਰ ਨਹੀਂ ਘਰ ਦੇ ਵਿੱਚ ਵੀ ਉਹ ਸੁੰਦਰ ਜਿਹੜੇ ਹਨ ਦ੍ਰਿਸ਼ ਹਨ ਉਹ ਮੈਨੂੰ ਮਿਲਣ ਹਰ ਤਰਫ਼ ਹਰਿਆਲੀ ਨਜ਼ਰ ਆਵੇ ਘਰ ਦੇ ਅੰਦਰ ਵੀ ਅਤੇ ਉਹਨਾਂ ਦੇ ਫੁੱਲ ਵੀ ਨਜ਼ਰ ਆਉਣ ਫਿਰ ਮੈਂ ਆਪਣੇ ਘਰ ਦੇ ਵਿੱਚ ਗਾਰਡਨਿੰਗ ਸ਼ੁਰੂ ਕੀਤੀ ਉਹ ਬਾਗਬਾਨੀ ਸ਼ੁਰੂ ਕੀਤੀ ਅਤੇ ਉੱਥੇ ਪਹਿਲਾਂ ਮੈਂ ਆਪਣੇ ਗੁਲਾਬ ਦੇ ਫੁੱਲ ਗੈਂਦੇ ਦੇ ਫੁੱਲ ਅਤੇ ਸੂਰਜਮੁਖੀ ਦੇ ਫੁੱਲਾਂ ਦੇ ਬੂਟੇ ਲਗਾਏ ਅਤੇ ਉਸ ਜਗ੍ਹਾ ਦੇ ਉੱਤੇ ਜਾ ਕੇ ਫਿਰ ਮੈਂ ਥੋੜ੍ਹੇ ਬਹੁਤ ਹੋਰ ਗਾਰਡਨਿੰਗ ਕੀਤੀ ਅਤੇ ਉਹਦੇ ਡੇਲੀ ਰੋਜ਼ ਮਰਾ ਦੀਆਂ ਜਿਹੜੀਆਂ ਸਬਜ਼ੀਆਂ ਹਨ ਉਹ ਵੀ ਲਗਾ ਲਈਆਂ ਜਿਨ੍ਹਾਂ ਨੂੰ ਮੈਨੂੰ ਤਾਜ਼ੀਆਂ ਸਬਜ਼ੀਆਂ ਮਿਲਣ ਲੱਗ ਗਈਆਂ ਅਤੇ ਸਵੇਰੇ ਉੱਠ ਕੇ ਜਾ ਕੇ ਉੱਥੇ ਮੈਂ ਸੈਰ ਵੀ ਕਰਦਾ ਸੀ ਆਪਣਾ ਛੋਟੇ ਜਿਹੇ ਲੋਨ ਦੇ ਵਿੱਚ ਅਤੇ ਉਹਦੇ ਨਾਲ ਸਾਨੂੰ ਉੱਥੇ ਸ਼ੁੱਧ ਹਵਾ ਮਿਲਦੀ ਸੀ ਸ ਅੱਛੀ ਔਕਸੀਜਨ ਮਿਲਣੀ ਸ਼ੁਰੂ ਹੋ ਗਈ ਅਤੇ ਉਹਦੇ ਨਾਲ ਅੱਖਾਂ ਨੂੰ ਅੱਛੀ ਮਤਲਬ ਹਰਿਆਲੀ ਦਿਖਣੀ ਸ਼ੁਰੂ ਹੋ ਗਈ ਉਹਦਾ ਬਹੁਤ ਹੀ ਮੈਨੂੰ ਫ਼ਾਇਦਾ ਹੋਇਆ ਤੇ ਅਤੇ ਉਸ ਤੋਂ ਬਾਅਦ ਉਹ ਮੈਂ ਘਰ ਦੇ ਵਿੱਚ ਹੀ ਸਭ ਕੁਛ ਅ ਕਰਦਾ ਰਿਹਾ